ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਕਿ ਮੈਨੇ ਔਨਲਾਈਨ ਡਿਲੀਵਰੀ ਮੰਗਵਾਈ ਸੀ ਤੁਹਾਡੇ ਵੱਲੋਂ ਅਤੇ ਜਿਸ ਤਰ੍ਹਾਂ ਕਿ ਤੁਹਾਡਾ ਡਿਲੀਵਰੀ ਮੈਨ ਸਭ ਤੋਂ ਪਹਿਲੇ ਤੇ ਗੱਲ ਕਰਾਂਗੇ ਡਿਲੀਵਰੀ ਮੈਨ ਦੀ ਮੈਂ ਉਹਨੂੰ ਦੱਸਿਆ ਮੈਂ ਆਪਣੇ ਘਰ ਦਾ ਰਸਤਾ ਦੱਸਿਆ ਪਰ ਉਹ ਨੇ ਬਹੁਤ ਉਲਝਣ ਪਾਈ ਟਾਈਮ 'ਤੇ ਉਹ ਪਹੁੰਚਿਆ ਨਹੀਂ ਜਿਹਦੇ ਨਾਲ ਮੈਨੂੰ ਜਿਹੜਾ ਹੈਗਾ ਮੇਰਾ ਟਾਈਮ ਖਰਾਬ ਹੋਇਆ ਦੂਸਰੀ ਗੱਲ ਜਦੋਂ ਤੁਹਾਡੀ ਪੈਕ ਪੈਕਿੰਗ ਜਿਹੜਾ ਮਿਲਿਆ ਮੈਨੂੰ ਪੈਕਟ ਮਿਲਿਆ ਉਹ ਸਹੀ ਨਹੀਂ ਮਿਲਿਆ ਸਾਰਾ ਇਹ ਪਤਾ ਨਹੀਂ ਕੀ ਹੋਇਆ ਹੋਇਆ ਸੀਗਾ ਸਾਰਾ ਖਰਾਬ ਹੋਇਆ ਹੋਇਆ ਸੀ ਅਤੇ ਇਹ ਬਹੁਤ ਗਲਤ ਜਿਹੜਾ ਹੈਗਾ ਮੇਰੇ ਉੱਤੇ ਅਸਰ ਪਿਆ ਤੁਹਾਡੀ ਚੀਜ਼ ਮੰਗਵਾਉਣ ਦਾ ਅਤੇ ਦੂਸਰੀ ਨ ਇਹ ਹੈ ਕਿ ਜਿਹੜਾ ਪ੍ਰੋਡਕਟ ਮੈਨੇ ਮੰਗਵਾਇਆ ਸੀ ਇਹ ਮੰਗਵਾਇਆ ਸੀ ਚੋਪਰ ਜਿਹਦੀ ਪਲਾਸਟਿਕ ਇੰਨੀ ਬੁਰੀ ਸੀ ਔਰ ਜਿਹੜੇ ਇਹਦੇ ਕਟਰ ਸੀਗੇ ਉਹ ਵੀ ਸ਼ਾਰਪ ਨਹੀਂ ਹੈ ਔਰ ਬੂਟ ਬਹੁਤ ਬੁਰੀ ਹਾਲਤ ਨਾਲ ਮਿਲਿਆ ਜਿਹੜਾ ਮੈਨੂੰ ਪਸੰਦ ਨਹੀਂ ਆਇਆ ਅੱਗੇ ਤੋਂ ਜਿਹੜਾ ਹੈਗਾ ਮੈਂ ਤੁਹਾਡੇ ਵੱਲੋਂ ਜਿਹੜਾ ਹੈਗਾ ਏ ਗਲਤ ਪ੍ਰੋਡਕਟ ਜਿਹੜਾ ਮੰਗਵਾਉਣ ਤੋਂ ਗੁਰੇਜ਼ ਕਰਾਂਗੀ ਹੁਣ ਪਲੀਜ਼ ਮੇਰੀ ਜਿਹੜੀ ਇਹ ਰਿਕੁਐਸਟ ਹੈਗੀ ਹੈ ਕਿ ਜਿਹੜਾ ਜਾਂ ਫਿਰ ਮੇਰਾ ਰਿਟਰਨ ਪਾਇਆ ਜਾਵੇ ਜਾਂ ਜਿਹੜਾ ਹੈਗਾ ਮੈਨੂੰ ਪ੍ਰੋਡਕਟ ਸਹੀ ਭੇਜਿਆ ਜਾਵੇ ਧੰਨਵਾਦ ਜੀ